ਪਿਛਲੇ ਕੁਝ ਸਾਲਾਂ ਵਿੱਚ ਭਾਰਤ ਦੀ ਅਰਥ ਵਿਵਸਥਾ ਦੇ ਵਿੱਚ ਕਾਫ਼ੀ ਵਿਕਾਸ ਹੋਇਆ ਹੈ ਇਸ ਦੇ ਲਈ ਭਾਰਤ ਦੀ ਸਰਕਾਰ ਨੇ ਕੁਝ ਯੋਜਨਾਵਾਂ ਵੀ ਸ਼ੁਰੂ ਕੀਤੀਆਂ ਹਨ ਜਿਹਨਾਂ ਦੇ ਵਿੱਚੋਂ ਮੇਕ ਇਨ ਇੰਡੀਆਂ ਵੀ ਭਾਰਤ ਦੀ ਅਰਥ ਵਿਵਸਥਾ ਨੂੰ ਵਧਾਉਣ ਦੇ ਲਈ ਇੱਕ ਹੈ ਇਸ ਦੇ ਤਹਿਤ ਬਹੁਤ ਸਾਰੀ ਬਾਹਰੀ ਉਦਯੋਗ ਬਾਹਰੀ ਦੇਸ਼ ਆਪਣੀਆਂ ਕੰਪਨੀਆਂ ਭਾਰਤ ਵਿੱਚ ਸ ਸਥਾਪਿਤ ਕਰ ਰਹੇ ਹਨ ਜਿਵੇਂ ਕਿ ਚੀਨ ਨੇ ਮੋਬਾਇਲ ਉਦਯੋਗ ਭਾਰਤ ਵਿੱਚ ਸ਼ੁਰੂ ਕੀਤਾ ਹੈ ਇਸ ਤੋਂ ਇਲਾਵਾ ਬਹੁਤ ਸਾਰੇ ਬਾਹਰੀ ਕੰਪਨੀਆਂ ਜਿਵੇਂ ਕਿ ਕਾਰ ਬਾਈਕ ਆਦਿ ਵੀ ਭਾਰਤ ਵਿੱਚ ਸਥਾਪਿਤ ਹੋ ਰਹੇ ਹਨ ਭਾਰਤੀ ਸਰਕਾਰ ਨੇ ਭਾਰਤ ਨੂੰ ਡਿਜੀਟਲ ਬਣਾਉਣ ਦਾ ਸੰਕਲਪ ਕੀਤਾ ਹੈ ਇੰਟਰਨੈਟ ਬੈਂਕਿੰਗ ਅਤੇ ਡਿਜੀਟਲ ਭੁਗਤਾਨ ਨੇ ਵੀ ਵਿੱਤੀ ਖੇਤਰ ਦੇ ਵਿੱਚ ਬਹੁਤ ਹੀ ਮਦਦ ਕੀਤੀ ਹੈ